ਸਾਨੂੰ ਆਪਣੇ ਘਰ ਵਿੱਚ ਗੈਸ ਸਿਲੰਡਰ ਤੋਂ ਬਹੁਤ ਹੀ ਜ਼ਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ ਸਾਨੂੰ ਸਮੇਂ ਸਮੇਂ ਉੱਤੇ ਉਸ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਕਿ ਉਸ ਵਿੱਚੋਂ ਗੈਸ ਲੀਕ ਤਾਂ ਨਹੀਂ ਹੋ ਰਹੀ ਇਸ ਤੋਂ ਇਲਾਵਾ ਸਾਨੂੰ ਸਿਲੰਡਰ ਲਗਾਉਣ ਸਮੇਂ ਵੀ ਸਾਵਧਾਨ ਰਹਿਣਾ ਚਾਹੀਦਾ ਹੈ ਗੈਸ ਬਾਲ਼ਣ ਸਮੇਂ ਸਾਨੂੰ ਥੋੜ੍ਹੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਜਦੋਂ ਅਸੀਂ ਕੋਈ ਵੀ ਬਰਤਨ ਜਿਵੇਂ ਕਿ ਪ੍ਰੈਸ਼ਰ ਕੂਕਰ ਸਿਲੰਡਰ ਉੱਤੇ ਧਰਦੇ ਹਾਂ ਤਾਂ ਸਾਨੂੰ ਉਸ ਦਾ ਢੱਕਣ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਚਾਹੀਦਾ ਹੈ ਇਸ ਤੋਂ ਇਲਾਵਾ ਜਦੋਂ ਅਸੀਂ ਘਰ ਤੋਂ ਕਿਤੇ ਬਾਹਰ ਜਾਂਦੇ ਹਾਂ ਤਾਂ ਸਾਨੂੰ ਗੈਸ ਸਿਲੰਡਰ ਨੂੰ ਬੰਦ ਕਰਕੇ ਜਾਣਾ ਚਾਹੀਦਾ ਹੈ ਤਾਂ ਕਿ ਪਿੱਛੋਂ ਕੋਈ ਹਾਨੀ ਨਾ ਹੋ ਸਕੇ